ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਅਮਰਜੀਤ ਸਿੰਘ ਖਰੜ ਤੋਂ ਬੋਲ ਰਿਹਾ ਐ ਮੇਰੇ ਘਰ ਵਿੱਚ ਅੱਜ ਸ਼ਾਮ ਨੂੰ ਦਸ ਬੰਦੇ ਆ ਰਹੇ ਹੈ ਅਤੇ ਤੁਸੀਂ ਕੁਛ ਚੀਜ਼ਾਂ ਨੋਟ ਕਰ ਲਓ ਅਤੇ ਉਹ ਮੇਰੇ ਸ਼ਾਮੀ ਸਾਢੇ ਸੱਤ ਵਜੇ ਮੇਰੇ ਘਰ ਭੇਜ ਦਿਉ ਜਿਹਦੇ ਵਿੱਚ ਤੁਸੀਂ ਇੱਕ ਦਾਲ ਮੱਖਣੀ ਤੰਦੂਰੀ ਰੋਟੀ ਸੈਲਡ ਰਾਈਤਾ ਚਾਵਲ ਗੁਲਾਬ ਜਾਮਨ ਡਿਸ਼ ਵਿੱਚ ਅਤੇ ਇਹ ਜੋ ਵੀ ਹੈ ਤੁਹਾਡਾ ਜਿੰਨਾਂ ਵੀ ਬਿੱਲ ਹੈ ਅਤੇ ਮੈਨੂੰ ਦੱਸ ਦਿਉ ਅਤੇ ਮੈਂ ਤੁਹਾਨੂੰ ਗੂਗਲ ਪੇਅ ਜਾਂ ਪੇਟੀਐਮ ਦੇ ਥਰੂ ਸਕੈਨ ਕਰ ਦਵਾਂਗਾ